ਵਿਆਹ ਵਿੱਚ ਬਹੁਤ ਸਾਰੀਆਂ ਰਸਮਾਂ ਹੁੰਦੀਆਂ ਅਤੇ ਜਿਸ ਦਾ ਕਿ ਖਾਸ ਕਰਕੇ ਕਈ ਪਰਚੇ ਕਈ ਜ਼ਿਆਦਾ ਪਰਜਿਲਤ ਨੇ ਜਿ ਜਿਸ ਦਾ ਸਭ ਤੋਂ ਪਹਿਲਾਂ ਵਿਆਹ ਵਿੱਚ ਵਰੀ ਖਰੀਦੀ ਜਾਂਦੀ ਪਹਿਲਾਂ ਡੇਟ ਪੱਕੀ ਕੀਤੀ ਜਾਂਦੀ ਹੈ ਮੁੰਡੇ ਅਤੇ ਕੁੜੀ ਦੇ ਟੇਵੇ ਮਿਲਾਏ ਜਾਂਦੇ ਨੇ ਫਿਰ ਤਰੀਕ ਫਿਕਸ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਵਿਆਹ ਤੋਂ ਉਸ ਤੋਂ ਬਾਅਦ ਵਿਆਹ ਦੀ ਸ਼ੋਪਿੰਗ ਕੀਤੀ ਜਾਂਦੀ ਹੈ ਖਰੀਦਦਾਰੀ ਕਰਦੇ ਨੇ ਖਰੀਦਦਾਰੀ ਵਿੱਚ ਮੁੰਡੇ ਅਤੇ ਕੁੜੀ ਦੇ ਸਾਰੇ ਬਰੀ ਬਣਾਈ ਜਾਂਦੀ ਹੈ ਗਹਿਣੇ ਬਣਾਏ ਜਾਂਦੇ ਨੇ ਨੌਕ ਦੇਣ ਲੈਣ ਵਾਸਤੇ ਕੱਪੜੇ ਦਿੱਤੇ ਜਾਂਦੇ ਨੇ ਨੌਗੇ ਬਣਾਏ ਜਾਂਦੇ ਨੇ ਉਸ ਤੋਂ ਬਾਅਦ ਖਾਸ ਖਾਸ ਜਿਹੜੇ ਘਰ ਦੇ ਜੀ ਹੁੰਦੇ ਹੈ ਮਹਿਮਾਨ ਹੁੰਦੇ ਹੈ ਉਹਨਾਂ ਨੂੰ ਨਾਲ ਲੈ ਕੇ ਜਾਂਦੇ ਨੇ ਉਸ ਤੋਂ ਬਾਅਦ ਫਿਰ ਉਹ ਫਿਰ ਮਾਈਆਂ ਫਿਰ ਵਿਆਹ ਦਾ ਦਿਨ ਨੇੜੇ ਆਈ ਜਾਂਦੇ ਨੇ ਫਿਰ ਪਹਿਲਾਂ ਸਭ ਤੋਂ ਪਹਿਲਾਂ ਪੰਜਵੇਂ 'ਤੇ ਤੇਲ ਲਗਾਇਆ ਜਾਂਦਾ ਹੈ ਕੁੜੀ ਦਾ ਵਿਆਹ ਏ ਅਤੇ ਤੇਲ ਲਗਾਇਆ ਜਾਂਦਾ ਏ ਰਾਤ ਨੂੰ ਗੌਣ ਬਿਠਾਏ ਜਾਂਦੇ ਨੇ ਤੇਲ ਲਈ ਸਾਰੇ ਆਂਢ ਗਵਾਂਢ ਰਿਸ਼ਤੇਦ ਕੁਛ ਕੁਛ ਰਿਸ਼ਤੇਦਾਰ ਆਉਂਦੇ ਨੇ ਫਿਰ ਉਹਨਾਂ ਨੂੰ ਚਾਹ ਪਾਣੀ ਪਿਲਾਇਆ ਜਾਂਦਾ ਏ ਕੁਛ ਖਾਣ ਵਾਸਤੇ ਦਿੱਤਾ ਜਾਂਦਾ ਗੁਣੇ ਵਗੈਰਾ ਬਣਾਏ ਜਾਂਦੇ ਨੇ ਇਸ ਤਰ੍ਹਾਂ ਕੁੜੀ ਨੂੰ ਤੇਲ ਅਤੇ ਮਾਈਆਂ ਮਾਈਆਂ ਵੀ ਕਹਿ ਸਕਦੇ ਹਾਂ ਉਸ ਤੋਂ ਬਾਅਦ ਸ਼ਾਮ ਗੌਣ ਗੌਣ ਬਣਾਏ ਜਾਂਦੇ ਨੇ ਗੌਣ ਵਿੱਚ ਆਂਢ ਗੁਆਂਢ ਦੀਆਂ ਜਨਾਨੀਆਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਨੇ ਬੋਲੀਆਂ ਪਾਉਂਦੀਆਂ ਨੇ ਗਿੱਧਾ ਪਾਉਂਦੀਆਂ ਨੇ ਫਿਰ ਉਸ ਤੋਂ ਬਾਅਦ ਸਾਰੇ ਜਣੇ ਇਕੱਠੇ ਹੋ ਕੇ ਕਾਫੀ ਚੀਜ਼ਾਂ ਕਾਫੀ ਰੌਣਕ ਮੇਲਾ ਹੁੰਦਾ ਏ ਉਸ ਤੋਂ ਬਾਅਦ ਵਿਆਹ ਸਗ ਇੱਕ ਦਿਨ ਪਹਿਲਾਂ ਸ਼ਗਨ ਲਾਇਆ ਜਾਂਦਾ ਏ ਸ਼ਗਨ ਵਿੱਚ ਸ਼ਗਨ ਵਿੱਚ ਮੁੰਡੇ ਅਤੇ ਮ ਕੁੜੀ ਵਾਲੇ ਮੁੰਡੇ ਨੂੰ ਸ਼ਗਨ ਲਾਉਣ ਜਾਂਦੇ ਨੇ ਸ਼ਗਨ ਵਿੱਚ ਫਲ ਦੀ ਟੋਕਰੀ ਕੱਪੜੇ ਲੀੜੇ 'ਚ ਸੋਨੇ ਦਾ ਗਹਿਣਾ ਵੀ ਲੈ ਕੇ ਜਾਇਆ ਜਾਂਦਾ ਏ ਫਿਰ ਉੱਥੇ ਜਾ ਕੇ ਕਾਫੀ ਮਤਲਬ ਜਿੱਦਾਂ ਵਧੀਆ ਖਾਣ ਪੀਣ ਦਾ ਪ੍ਰਬੰਧ ਹੁੰਦਾ ਏ ਉਹ ਕੀਤਾ ਜਾਂਦਾ ਏ ਉਸ ਤੋਂ ਬਾਅਦ ਸਾਰੇ ਜਣੇ ਉੱਥੇ ਪਿਆਰ ਦਿੰਦੇ ਨੇ ਮੁੰਡੇ ਨੂੰ ਬਿਠਾਇਆ ਜਾਂਦਾ ਫਿਰ ਸਾਰੇ ਘਰ ਆ ਜਾਂਦੇ ਨੇ ਰਿਸ਼ਤੇਦਾਰ ਸੱਦੇ ਹੁੰਦੇ ਸਾਰੇ ਘਰ ਆ ਜਾਂਦੇ ਨੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਰਾਤ ਨੂੰ ਜਾਗੋ ਬਣਾਈ ਕੱਢੀ ਜਾਂਦੀ ਹੈ ਜਾਗੋ ਵਿੱਚ ਵੀ ਡੀ ਜੇ ਲਾਏ ਜਾਂਦੇ ਹੈ ਜਾਗੋ ਬੋਲੀਆਂ ਪਾਈਆਂ ਜਾਂਦੀਆਂ ਢੋਲੀ ਸੱਦਿਆ ਜਾਂਦਾ ਏ ਸਾਰੇ ਕਾਫੀ ਇੰਜੋਏ ਕਰਦੇ ਨੇ ਜੋ ਕਿ ਪੰਜਾਬ ਵਿੱਚ ਬਹੁਤ ਵਧੀਆ ਤਰੀਕੇ ਨਾਲ ਜਾਗੋ ਨ ਕੱਢੀ ਜਾਂਦੀ ਹੈ ਉਸ ਤੋਂ ਬਾਅਦ ਅਗਲੇ ਦਿਨ ਫਿਰ ਬਰਾਤ ਆਉਂਦੀ ਹੈ ਤਿਆਰ ਹੋਇਆ ਜਾਂਦਾ ਹੈ ਕੁੜੀ ਨੂੰ ਪਹਿਲਾਂ ਖਾਰੇ ਲਾਇਆ ਜਾਂਦਾ ਖਾਰਾ ਮਤਲਬ ਪਹਿਲਾਂ ਤੇਲ ਚੜ੍ਹਾਇਆ ਜਾਂਦਾ ਕ ਦਹੀਂ ਚੜ੍ਹਾਇਆ ਜਾਂਦਾ ਦਹੀਂ ਤੋਂ ਬਾਅਦ ਫਿਰ ਉਸ ਨੂੰ ਤਿਆਰ ਕਰਕੇ ਫਿਰ ਉਸਨੂੰ ਤਿਆਰ ਕਰਕੇ ਫਿਰ ਗੁਰੂ ਆਨੰਦ ਕਾਰਜ ਹੁੰਦੇ ਨੇ ਆਨੰਦ ਬਰਾਤ ਆ ਜਾਂਦੀ ਬਰਾਤ ਦਾ ਸਵਾਗਤ ਕੀਤਾ ਜਾਂਦਾ ਫਿਰ ਆਨੰਦ ਕਾਰਜ ਹੁੰਦੇ ਨੇ ਆਨੰਦ ਕਾਰਜ ਵਿੱਚ ਪਾ ਪਾਠੀ ਸਿੰਘ ਗ੍ਰੰਥੀ ਲਾਵਾਂ ਦਾ ਪਾਠ ਕਰਦੇ ਨੇ ਅਤੇ ਅ ਆਨੰਦ ਕਾਰਜ ਹੋ ਜਾਂਦੇ ਨੇ ਉਸ ਤੋਂ ਬਾਅਦ ਫਿਰ ਅ ਅ ਕੁੜੀ ਮੁੰਡੇ ਨੂੰ ਸਟੇਜ ਕ ਚਾਹ ਪਾਣੀ ਦਾ ਪ ਪ੍ਰਬੰਧ ਕੀਤਾ ਜਾਂਦਾ ਹੈ ਬਰਾਤ ਚਾਹ ਪਾਣੀ ਪੀਂਦੀ ਹੈ ਫਿਰ ਉਸ ਤੋਂ ਬਾਅਦ ਸਾਰੇ ਜਣੇ ਇਕੱਠੇ ਹੋ ਕੇ ਮੁੰਡੇ ਅਤੇ ਕੁੜੀ ਨੂੰ ਸਟੇਜ 'ਤੇ ਬਿਠਾ ਕੇ ਉਹਨਾਂ ਨੂੰ ਪਿਆਰ ਅਤੇ ਸਤਿਕ ਪਿਆਰ ਦਿੱਤਾ ਜਾਂਦਾ ਪਿਆਰ ਦੇ ਕੇ ਉਸ ਤੋਂ ਬਾਅਦ ਫਿਰ ਸਾਰੇ ਜਣੇ ਕੁੜੀ ਨੂੰ ਫਿਰ ਖਾਣਾ ਖਿਲਾਇਆ ਜਾਂਦਾ ਹੈ ਫਿਰ ਕੁੜੀ ਦੀ ਡੋਲੀ ਤੋਰੀ ਜਾਂਦੀ ਹੈ ਇਸ ਤਰ੍ਹਾਂ ਕਰਕੇ ਵਿਆਹ ਦੀਆਂ ਕਈ ਰਸਮਾਂ ਹੈ ਜਿਹੜੀਆਂ ਬਹੁਤ ਪਰਚੀਲਤ ਨੇ ਸੱਭਿਆਚਾਰ ਨਾਲ ਜੋੜਦੀਆਂ ਨੇ ਜੋ ਸਾਨੂੰ ਜੁੜਿਆ ਰਹਿਣਾ ਚਾਹੀਦਾ ਹੈ ਜਦੋਂ ਕੁੜੀ ਘਰ ਆਉਂਦੀ ਹੈ ਅਤੇ ਉਹਦੇ ਸਹੁਰੇ ਪਰਿਵਾਰ ਵਾਲੇ ਮੁੰਡੇ ਦੇ ਘਰ ਆਉਂਦੀ ਹੈ ਤਾਂ ਉਹਦੀ ਸ ਸੱਸ ਉਹਦਾ ਪਾਣੀ ਵਾਰਦੀ ਹੈ ਪਾਣੀ ਵਾਰ ਕੇ ਫਿਰ ਉਸਨੂੰ ਪਾਣੀ ਵਾਰਿਆ ਜਾਂਦਾ ਫਿਰ ਉਸ ਨੂੰ ਅੱਗੇ ਘਰ ਘਰ ਲੰਗਾਇਆ ਤੇਲ ਚੋ ਕੇ ਘਰ ਲੰਗਾਇਆ ਜਾਂਦਾ ਇਸ ਤਰਾਂ ਕਰਕੇ ਫਿਰ ਮੁੰਡੇ ਵਾਲੇ ਸ਼ਗਨ ਸੁਆਰਥ ਕਰਦੇ ਆ ਫਿਰ ਇਸ ਦਾ ਕੁੜੀ ਦਾ ਇਸ ਤਰ੍ਹਾਂ ਕਰਕੇ ਕੁੜੀ ਦਾ ਵਿਆਹ ਸੰਪੰਨ ਸਾਰੇ ਵਿਆਹ ਸਾਰਾ ਵਿਆਹ ਸੰਪੰਨ ਹੋ ਜਾਂਦਾ ਹੈ